ਸਾਡੇ ਜ਼ਿਲ੍ਹੇ ਦੇ ਵਿੱਚ ਪੂਜਾ ਸਥਾਨ ਹਰ ਇੱਕ ਧਰਮ ਦਾ ਹੈ ਜਿਵੇਂ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਚਰਚ ਗੁਰਦੁਆਰਾ ਸਾਹਿਬ ਮੇਨ ਵੱਡੇ ਗੁਰਦੁਆਰਾ ਸਾਹਿਬ ਨੇ ਜੋ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਭੱਠਾ ਸਾਹਿਬ ਇਹ ਵੱਡੇ ਗੁਰਦੁਆਰਾ ਸਾਹਿਬ ਨੇ ਇੱਥੇ ਲੋਕ ਸਵੇਰੇ ਦੁਪਹਿਰੇ ਸ਼ਾਮ ਆਪਣੀ ਆਪਣੇ ਸੱਭਿਆਚਾਰ ਦੇ ਮੁਤਾਬਿਕ ਨਸਮਤਕ ਨਸਮਸਤਕ ਹੁੰਦੇ ਹਨ ਅਤੇ ਆਪਣੇ ਗੁਰੂ ਤੋਂ ਅਸੀਸਾਂ ਪ੍ਰਾਪਤ ਕਰਦੇ ਹਨ ਸਾਡੇ ਜ਼ਿਲ੍ਹੇ ਦੇ ਵਿੱਚ ਹੋਲੇ ਮਹੱਲੇ 'ਤੇ ਲੰਗਰ ਲਗਾਏ ਜਾਂਦੇ ਹਨ ਜੋ ਬਹੁਤ ਵੱਡੀ ਮਾਤਰਾ ਵਿੱਚ ਲਾਏ ਜਾਂਦੇ ਹਨ ਮੇਰੇ ਪਿੰਡ ਦਾ ਵੀ ਲੰਗਰ ਹੋਲੇ ਮਹੱਲੇ ਨੂੰ ਚਾਰ ਦਿਨ ਸ਼੍ਰੀ ਚਮਕੌਰ ਸਾਹਿਬ ਤੋਂ ਰੋਪੜ ਨੂੰ ਜਾਂਦੇ ਹੋਏ ਰੋਡ ਦੇ ਉੱਤੇ ਰੈਲੋਂ ਦੇ ਪੁਲ 'ਤੇ ਲੱਗਦਾ ਹੈ ਚਾਰੋਂ ਦਿਨ ਗੁਰੂ ਕੀ ਸੰਗਤ ਲੰਗਰ ਛੱਕ ਕੇ ਜਾਂਦੀ ਹੈ ਅਤੇ ਲੰਗਰ ਦੇ ਵਿੱਚ ਰੋਜ਼ਾਨਾ ਤਰ੍ਹਾਂ ਤਰ੍ਹਾਂ ਦਾ ਲੰਗਰ ਬਣਿਆ ਜਾਂ ਬਣਾਇਆ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਾਰੋਂ ਦਿਨ ਜਲੇਬੀਆਂ ਦਾ ਲੰਗਰ ਖੂਬ ਚਲਦਾ ਹੈ ਅਤੇ ਇਸੇ ਤਰ੍ਹਾਂ ਦਸੰਬਰ ਮਹੀਨੇ ਦੇ ਵਿੱਚ ਜ਼ਿਲ੍ਹੇ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਜੋ ਬਹੁਤ ਹੀ ਉੱਚੇ ਪੱਧਰ 'ਤੇ ਮਨਾਇਆ ਜਾਂਦਾ ਹੈ ਅਤੇ ਲੰਗਰ ਲਗਾਏ ਜਾਂਦੇ ਹਨ